ਹਾਂਜੀ ਬਿਲਕੁਲ ਇੱਕ ਮੈਂ ਆਪਣੀ ਸਹੇਲੀ ਤੋਂ ਕੈਮਰਾ ਲੈ ਕੇ ਉਸ ਨਾਲ਼ ਸ਼ੂਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਬਿਲਕੁਲ ਇਹਦੀ ਜਿਹੜੀ ਸ਼ੂਟਿੰਗ ਦੀ ਜਿਹੜੀ ਜੋ ਵੀ ਪ੍ਰੋਸੀਜਰ ਹੈ ਉਹ ਡਿਜੀਟਲ ਫੋਟੋਗ੍ਰਾਫੀ ਤੋਂ ਬਹੁਤ ਜ਼ਿਆਦਾ ਬਿਲਕੁਲ ਵੱਖਰਾ ਹੈ ਅਤੇ ਉਸਦੀ ਕਲੈਰਿਟੀ ਦਾ ਅਤੇ ਉਸਦੀ ਜਿਹੜੀ ਉਹਨੂੰ ਉਹਦੇ ਉਹਦੇ ਓਪਰੇਟਿੰਗ ਸਿਸਟਮ ਹੈ ਬਹੁਤ ਹੀ ਵੱਖਰੇ ਹੈ